ਪਸ਼ੂ ਪ੍ਰਜਨਣ ਦੇ ਕਈ ਤਰੀਕੇ ਹਨ ਜਿੱਦਾਂ ਕੁਦਰਤੀ ਪ੍ਰਜਨਣ ਕੁਦਰਤੀ ਚੋਣ ਜਿੱਦਾਂ ਕ੍ਰਿਤਰਨ ਕ੍ਰਿਤਰਨ ਕੱਰਿਤਰਮ ਚੋਣ ਇਸ ਤਰ੍ਹਾਂ ਦੇ ਤਰੀਕੇ ਹਨ ਅਤੇ ਪਸ਼ੂਆਂ ਦੇ ਤਰੀਕੇ ਵੱਖ ਵੱਖ ਤਰ੍ਹਾਂ ਦੇ ਹਨ ਅਤੇ ਅਗਰ ਸਾਡੇ ਇਲਾਕੇ ਵਿੱਚ ਇੱਕ ਤਰੀਕਾ ਅਪਣਾਇਆ ਜਾਂਦਾ ਹੈ ਉਹ ਤਰੀਕਾ ਹੈਗਾ ਸਭ ਤੋਂ ਸਾਡੇ ਇਲਾਕੇ ਵਿੱਚ ਕ੍ਰਿਤਰਮ ਤਰੀਕਾ ਸਭ ਤੋਂ ਵਧੀਆ ਅਪਣਾਇਆ ਜਾਂਦਾ ਹੈ ਇਸ ਤਰੀਕੇ ਨਾਲ ਇੱਕ ਤਾਂ ਇਹ ਪਸ਼ੂਆਂ ਲਈ ਹਾ ਪਸ਼ੂਆਂ ਲਈ ਸਵੱਸਥੇ ਲਈ ਬਹੁਤ ਅੱਛਾ ਹੈ ਅਤੇ ਸਭ ਤੋਂ ਵਧੀਆ ਸਾਬਿਤ ਹੋਇਆ ਹੈ ਇਹ ਵਿਧੀ ਰੋਗਾਂ ਤੋਂ ਮੁੱਖ ਹੈ ਅਤੇ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਹੈ ਵੱਡੇ ਵੱਡੇ ਪਸ਼ੂ ਪਾਲਕ ਇਸੇ ਤਰੀਕੇ ਦਾ ਇਸਤੇਮਾਲ ਕਰਦੇ ਹਨ ਲੇਕਿਨ ਕਈ ਵਾਰ ਛੋਟੇ ਛੋਟੇ ਜਿਹੜੇ ਪਸ਼ੂ ਪਾਲਕ ਹੈਗੇ ਆ ਉਹ ਇਸ ਤਰੀਕੇ ਦਾ ਇਸਤੇਮਾਲ ਨਹੀਂ ਕਰਦੇ ਹਨ ਉਹਨਾਂ ਨੂੰ ਵੀ ਇਸ ਤਰੀਕੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਇਸ ਤਰੀਕੇ ਨਾਲ ਪਸ਼ੂਆਂ ਦੀ ਨਸਲ ਵੀ ਵਧੀਆ ਪੈਦਾ ਹੁੰਦੀ ਹੈ ਅਤੇ ਪਸ਼ੂ ਬੱਚਿਆਂ ਪਸ਼ੂਆਂ ਦੇ ਬੱਚਿਆਂ ਨੂੰ ਕੋਈ ਬਿਮਾਰੀ ਵੀ ਨਹੀਂ ਹੁੰਦੀ ਹੈ ਅਤੇ ਇਸ ਲਈ ਸਭ ਤੋਂ ਵਧੀਆ ਤਰੀਕਾ ਸਾਡੇ ਖੇਤਰ ਵਿੱਚ ਆਹੀ ਹੈ ਅਤੇ ਇਸ ਤਰੀਕੇ ਨਾਲ ਪਸ਼ੂਆਂ ਦਾ ਪ੍ਰਜਨਣ ਕਰਵਾਉਣਾ ਸਭ ਤੋਂ ਆਸਾਨ ਅਤੇ ਵਧੀਆ ਤਰੀਕਾ ਹੈ ਅਤੇ ਸਾਰੇ ਛੋਟੇ ਪਸ਼ੂ ਪਾਲਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸੇ ਤਰੀਕੇ ਨਾਲ ਪਸ਼ੂਆਂ ਦਾ ਪ੍ਰਜਨਣ ਕਰਵਾਉਣ ਅਤੇ ਇਸ ਤਰੀਕੇ ਨਾਲ ਪ੍ਰਜਨਣ ਕਰਾਉਣ ਨਾਲ ਪਸ਼ੂ ਸਵੱਸਥ ਰਹਿਣਗੇ